ਹੈਲੋ ਤੁਸੀਂ ਸਵੀਗੀ ਤੋਂ ਬੋਲ ਰਹੇ ਹਾਂਜੀ ਥੋੜ੍ਹੇ ਕੁ ਟਾਈਮ ਪਹਿਲਾਂ ਮੈਂ ਔਨਲਾਈਨ ਐਪ ਸ਼ੇ ਤੋਂ ਕੁਝ ਕੁ ਸ਼ੇਕ ਔਡਰ ਕੀਤੇ ਸੀ ਜਿਹਦੇ 'ਚ ਕੁਝ ਕੁ ਬਨਾਨਾ ਸ਼ੇਕ ਸੀ ਅਤੇ ਕੁਝ ਕੁ ਸਟੋਬਰੀ ਸ਼ੇਕ ਸੀ ਚਲੋ ਅ ਜਿਹੜੇ ਸ਼ੇਕ ਸੀ ਮੈਨੂੰ ਆਪਣੇ ਟਾਈਮ 'ਤੇ ਮਿਲ ਗਏ ਕਿਉਂਕਿ ਸਾਡੇ ਘਰ ਜਿਹੜਾ ਸੀ ਜਨਮ ਦਿਨ ਦਾ ਪ੍ਰੋਗਰਾਮ ਸੀ ਵੀਹ ਇੱਕੀ ਬੰਦਿਆਂ ਦੇ ਪ੍ਰੋਗਰਾਮ ਕਰਕੇ ਮੈਂ ਤੁਹਾਡੇ ਰੈਸਟੋਰੈਂਟ ਤੋਂ ਕੁਝ ਕੁ ਸ਼ੇਕ ਔਡਰ ਕੀਤੇ ਸੀ ਪਰ ਜਿਹੜੇ ਉਹ ਸ਼ੇਕ ਸੀ ਉਹ ਬੁਰੀ ਤਰ੍ਹਾਂ ਖ਼ਰਾਬ ਹੋ ਚੁੱਕੇ ਸੀ ਕਿਉਂਕਿ ਜਿਹੜੀ ਉਹਨਾਂ ਦੀ ਪੈਕਜਿੰਗ ਸੀ ਉਹ ਬਿਲਕੁਲ ਹੀ ਖ਼ਰਾਬ ਸੀ ਜਿਹੜੀ ਇਹਨਾਂ ਦੀ ਪੈਕਜਿੰਗ ਸੀ ਉਹਦੇ ਕਰਕੇ ਜਿਹੜੇ ਸ਼ੇਕ ਸੀ ਉਹ ਬਿਲਕੁਲ ਹੀ ਲੀਕ ਹੋ ਗਏ ਉਹ ਨਾ ਹੀ ਹੁਣ ਪੀਣ ਯੋਗ ਹੀ ਰਹੇ ਆ ਸਾਡੇ ਜਿਹੜੇ ਸਾਰੇ ਮਹਿਮਾਨ ਸੀ ਉਹ ਵੇਖਣ ਡੇ ਆ ਕਿਉਂਕਿ ਜਿਹੜੇ ਉਹ ਪੈਕਜਿੰਗ ਸੀ ਉਹ ਖ਼ਰਾਬ ਹੋ ਗਈ ਨਾ ਹੀ ਉਹ ਪੀਣ ਯੋਗ ਹੀ ਰਹੇ ਆ ਤੁਸੀਂ ਕਿਰਪਾ ਕਰਕੇ ਜਿਹੜੀ ਇਹ ਮੇਰੀ ਸ਼ਿਕਾਇਤ ਆ ਉਹ ਦਰਜ ਕਰੋ ਮੈਨੂੰ ਜਾਂ ਤਾਂ ਮੇਰੇ ਸ਼ੇਕ ਦੀ ਬਦਲੀ ਕਰੋ ਅਤੇ ਜਾਂ ਫਿਰ ਜਿਹੜੇ ਮੇਰੇ ਪੈਸੇ ਆ ਉਹ ਰਿਫੰਡ ਕਰੋ ਕਿਉਂਕਿ ਜਿਹੜਾ ਤੁਹਾਡਾ ਰੈਸਟੋਰੈਂਟ ਦਾ ਨਾਮ ਬਣਿਆ ਹੈ ਉਹ ਨਾ ਖ਼ਰਾਬ ਹੋਏ ਤੁਸੀਂ ਆਪਣੀ ਜਿਹੜੀ ਪੈਕਜਿੰਗ ਆ ਬੜੀ ਚੰਗੀ ਕਰਿਆ ਕਰੋ ਜਿਹਦੇ ਕਰਕੇ ਤੁਹਾਡਾ ਜਿਹੜੇ ਸ਼ੇਕ ਆ ਇਹ ਖ਼ਰਾਬ ਨਾ ਹੋਣ